ਟੈਲੀਵਿਜ਼ਨ ਸਾਡੇ ਸਮਾਜ ਦੇ ਅੰਦਰ ਲੱਗਦਾ ਸੀ ਕਿ ਬਹੁਤ ਵੱਡਾ ਅਹਿਮ ਯੋਗਦਾਨ ਰੱਖਣਗੇ ਪਰ ਜੇਕਰ ਵੇਖਿਆ ਜਾਵੇ ਕਿ ਜਦੋਂ ਦਾ ਟੀ ਵੀ ਨੇ ਸਾਡੇ ਸਮਾਜ ਦੇ ਅੰਦਰ ਸਥਾਨ ਲਿਆ ਹੈ ਫਿਲਮਾਂ ਦੇ ਸਥਾਨ ਲਿਆ ਹੈ ਉਹਦੇ ਰਾਹੀਂ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜੀ ਹੈ ਉਹ ਟੀ ਵੀ ਵੱਲ ਦੇਖ ਕੇ ਝੁਕਾ ਵਧਾ ਕੇ ਕਿਤਾਬਾਂ ਉਹਨਾਂ ਨੇ ਪੜ੍ਹਨੀਆਂ ਛੱਡ ਦਿੱਤੀਆਂ ਪੜ੍ਹਾਈ ਦੇ ਵਿੱਚ ਉਹਨਾਂ ਦਾ ਲੈਵਲ ਨੀਵਾਂ ਹੁੰਦਾ ਜਾ ਰਿਹਾ ਹੈ ਅੱਖਾਂ ਦੀਆਂ ਬਿਮਾਰੀਆਂ ਸਾਨੂੰ ਟੀ ਵੀ ਦੇ ਰਾਹੀਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਕਰਾਈਮ ਦੇ ਵਿੱਚ ਸਾਡਾ ਬਹੁਤ ਵੱਡਾ ਵਾਧਾ ਹੋ ਰਿਹਾ ਟੀ ਵੀ ਦੇ ਵਿੱਚ ਵੇਖ ਕੇ ਬੱਚੇ ਐਸੀਆਂ ਹੀ ਹਰਕਤਾਂ ਕਰਦੇ ਹਨ ਸੋ ਇਸ ਕਰਕੇ ਟੀ ਵੀ ਸਾਡੇ ਸਮਾਜ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਛੱਡ ਰਿਹਾ ਹੈ